ਜਦੋਂ ਮੈਂ ਆਪਣੇ ਸਕੂਲ ਵਿੱਚ ਅੱਠਵੀਂ ਜਮਾਤ ਵਿੱਚ ਪੜ੍ਹਦੀ ਸੀ ਤਾਂ ਮੈਨੂੰ ਮੇਰੇ ਸਕੂਲ ਵੱਲੋਂ ਇੱਕ ਬਾਹਰ ਗਾਇਕ ਸੰਗੀਤ ਪ੍ਰੋਗਰਾਮ ਵਿੱਚ ਲੈ ਕੇ ਜਾਇਆ ਗਿਆ ਫਿਰ ਮੈਂ ਉੱਥੇ ਜਾ ਕੇ ਪੰਜਾਬ ਦੇ ਵੱਡੇ ਵੱਡੇ ਕਲਾਕਾਰਾਂ ਨੂੰ ਸੁਣਿਆ ਜਿੱਦਾਂ ਕਿ ਪੰਜਾਬ ਦੀ ਪੁਰਾਣੀ ਗਾਇਕਾ ਅਰਸ਼ਦੀਪ ਕੌਰ ਬਹੁਤ ਹੀ ਵਧੀਆ ਗਾਇਕਾ ਹੈ ਮੈਂ ਉਹਨਾਂ ਨੂੰ ਸੁਣ ਕੇ ਬਹੁਤ ਹੀ ਖੁਸ਼ ਹੋਈ ਉਸ ਦਿਨ ਤੋਂ ਮੇਰੇ ਦਿਲ ਵਿੱਚ ਵੀ ਗਾਉਣ ਦੀ ਰੁਚੀ ਪੈਦਾ ਹੋ ਗਈ ਅਤੇ ਮੈਂ ਵੀ ਸੋਚਿਆ ਕਿ ਮੈਂ ਅੱਗੇ ਜਾ ਕੇ ਆਪਣੇ ਆਪ ਨੂੰ ਇੱਕ ਵੱਡੀ ਗਾਇਕਾ ਬਣਾਵਾਂਗੀ